ਜਿਸ ਸਮੇਂ ਵਿੱਚ ਮੈਂ ਸਕੂਲ ਵਿੱਚ ਪੜ੍ਹਦੀ ਸੀ ਤਾਂ ਸਾਡੇ ਸਕੂਲ ਵਿੱਚ ਇੱਕ ਬਹੁਤ ਹੀ ਵੱਡੀ ਅਤੇ ਸੋਹਣੀ ਲਾਇਬ੍ਰੇਰੀ ਸੀ ਜੋ ਜਿਸ ਵਿੱਚ ਅਲਮਾਰੀਆਂ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਕਿਤਾਬਾਂ ਪਈਆਂ ਸਨ ਹਰੇਕ ਵਿਸ਼ੇ ਦੀਆਂ ਕਿਤਾਬਾਂ ਸਾਡੀ ਲਾਇਬ੍ਰੇਰੀ ਵਿੱਚ ਸਨ ਜਿਨ੍ਹਾਂ ਵਿੱਚ ਪੰਜਾਬੀ ਇੰਗਲਿਸ਼ ਹਿੰਦੀ ਹਰ ਤਰ੍ਹਾਂ ਦੀਆਂ ਕਿਤਾਬਾਂ ਸਨ ਮੈਨੂੰ ਕਹਾਣੀ ਵਾਲੀਆਂ ਕਿਤਾਬਾਂ ਪੜ੍ਹਣੀਆਂ ਬਹੁਤ ਹੀ ਜ਼ਿਆਦਾ ਪਸੰਦ ਸਨ ਜਿਨ੍ਹਾਂ ਤੋ ਸਾਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਹੈ ਸਾਡੀ ਲਾਇਬ੍ਰੇਰੀ ਵਿੱਚ ਬਹੁਤ ਹੀ ਸਾਰੀਆਂ ਹਰ ਭਾਸ਼ਾ ਦੀਆਂ ਕਿਤਾਬਾਂ ਹੁੰਦੀਆਂ ਸਨ ਔਰ ਮੈਂ ਰੋਜ਼ ਅਪਣੇ ਸਾਰੇ ਦਿਨ 'ਚੋਂ ਕੁਛ ਸਮਾਂ ਕੱਢ ਕੇ ਲਾਇਬ੍ਰੇਰੀ ਵਿੱਚ ਕਿਤਾਬਾਂ ਪੜ੍ਹਣ ਲਈ ਜਾਂਦੀ ਸੀ ਸਾਡੇ ਲਾਇਬ੍ਰੇਰੀ ਵਿੱਚ ਸਾਡੀ ਕਲਾ ਹਰ ਕਲਾਸ ਦੀ ਹਰ ਵਿਸ਼ੇ ਬਾਰੇ ਕਿਤਾਬਾਂ ਹੁੰਦੀਆਂ ਸਨ ਔਰ ਮੈਨੂੰ ਜਦੋਂ ਵੀ ਸਮਾਂ ਮਿਲਦਾ ਸੀ ਮੈਂ ਆਪਣੇ ਮਨਪਸੰਦ ਦੀਆਂ ਕਿਤਾਬਾਂ ਲਾਇਬ੍ਰੇਰੀ ਵਿੱਚ ਪੜ੍ਹਣ ਲਈ ਜਾਂਦੀ ਸੀ ਉੱਥੇ ਬਹੁਤ ਹੀ ਜ਼ਿਆਦਾ ਸ਼ਾਂਤ ਮਾਹੌਲ ਹੁੰਦਾ ਹੈ ਅਤੇ ਅਸੀਂ ਬੜੇ ਹੀ ਧਿਆਨ ਲਗਾ ਕੇ ਉੱਥੇ ਪੜ੍ਹਾਈ ਕਰ ਸਕਦੇ ਹਾਂ ਇਸ ਕਰਕੇ ਮੈਂ ਆਪਣੀ ਸਕੂਲ ਦੀ ਲਾਇਬ੍ਰੇਰੀ ਵਿੱਚ ਬਹੁਤ ਸਮਾਂ ਬਿਤਾਇਆ ਹੈ ਜਿਸ ਤੋਂ ਮੈਨੂੰ ਬਹੁਤ ਹੀ ਜ਼ਿਆਦਾ ਸਿੱਖਣ ਨੂੰ ਮਿਲਿਆ ਹੈ ਧੰਨਵਾਦ